ਸਤਿ ਸ਼੍ਰੀ ਅਕਾਲ ਸਰ ਮੈਂ ਮੀਨਾਕਸ਼ੀ ਪਠਾਨਕੋਟ ਤੋਂ ਬੋਲਦੀ ਹਾਂ ਅਤੇ ਮੈਨੂੰ ਸਾਈਕਲਿੰਗ ਦਾ ਬਹੁਤ ਹੀ ਸ਼ੌਂਕ ਹੈ ਜਿਸ ਕਾਰਣ ਮੈਂ ਸਾਈਕਲਿੰਗ ਸ਼ਾਮ ਸ਼ਾਮ ਦੇ ਟਾਈਮ ਸਾਈਕਲਿੰਗ ਜ਼ਰੂਰ ਕਰਦੀ ਹਾਂ ਅਤੇ ਵੈਸੇ ਤਾਂ ਮੈਂ ਕਈ ਕਈ ਜਗ੍ਹਾ 'ਤੇ ਦੂਰ ਸਾਈਕਲਿੰਗ ਕਰਨ ਤਾਂ ਨਹੀਂ ਗਈ ਲੇਕਿਨ ਮੈਂ ਮਿਨੀ ਗੋਆ ਜਾਣਾ ਚਾਹੁੰ ਸਾਈਕਲ 'ਤੇ ਮਿਨੀ ਗੋਆ ਜਾਣਾ ਚਾਹੁੰਦੀ ਹਾਂ ਜਿੱਥੇ ਕਿ ਸਾਈਕਲ ਸਾਈਕਲ ਚਲਾਉਂਦੇ ਵੇਲੇ ਤਾਜ਼ੀ ਹਵਾ ਆਨੰਦ ਲੈਣਾ ਚਾਹੁੰਦੇ ਹਾਂ ਜੋ ਵੀ ਸਾਡੇ ਕੋਲ ਸ਼ਹਿਰ ਵਿੱਚ ਇੱਕ ਨਵੀਂ ਜਗ੍ਹਾ ਖੁੱਲ੍ਹੀ ਹੈ ਜਿੱਥੇ ਕਿ ਪਾਣੀ ਦਾ ਵਿਊ ਅਤੇ ਤਾਜ਼ੀ ਹਵਾ ਦਾ ਆਨੰਦ ਲੈਣਾ ਚਾਹੁੰਦੇ ਹੈਗੇ ਅਤੇ ਬਹੁਤ ਵੱਡਾ ਸਮੁੰਦਰ ਹੈ ਬਚਪਨ ਵਿੱਚ ਅਸੀਂ ਸਾਈਕਲ ਚਲਾਉਂਦੇ ਸੀ ਅਤੇ ਕਿਉਂਕਿ ਸਾਡੇ ਕੋਲ ਸਕੂਟੀ ਵਗੈਰਾ ਹੋਰ ਕੋਈ ਸਾਧਨ ਨਹੀਂ ਸੀ ਹੁੰਦਾ ਜਿਸ ਕਾਰਣ ਲਾਗੇ ਸ਼ਾ ਲਾਗੇ ਸ਼ਾਗੇ ਸਾਈਕਲ 'ਤੇ ਜਾ ਜਾਂਦੇ ਸੀ ਅਤੇ ਬਾਜ਼ਾਰ ਵਗੈਰਾ ਸਾਈਕਲ 'ਤੇ ਆਉਣਾ ਜਾਣਾ ਕਰਦੇ ਸੀ ਅਤੇ ਜਿਸ ਕਾਰਣ ਹੁਣ ਸਾਈਕ ਸਾਈਕਲ ਕਰਨ ਕਾਰਣ ਸਾਡੇ ਮਾਸਪੇਸ਼ੀਆਂ ਠੀਕ ਰਹਿੰਦੀਆਂ ਹਨ ਅਤੇ ਸਾਇਕਲ ਚਲਾਉਣ ਨਾਲ ਲਹੂ ਪ੍ਰਣਾਲੀ ਠੀਕ ਰਹਿੰਦੀ ਹੈ ਅਤੇ ਇਸ